ਸਤਿ ਸ਼੍ਰੀ ਅਕਾਲ ਸਰ ਤੁਸੀਂ ਟਰਾਂਸਪੋਰਟ ਏਜੰਸੀ ਤੋਂ ਗੱਲ ਕਰ ਰਹੇ ਹੋ ਹਾਂਜੀ ਸਰ ਮੈਂ ਨਾ ਅਸਲ ਦੇ ਵਿੱਚ ਕੱਲ੍ਹ ਕੈਬ ਬੁਕਿੰਗ ਕਰਵਾਈ ਸੀ ਤੁਹਾਡੀ ਹੀ ਏਜੰਸੀ ਦੇ ਵਿੱਚੋਂ ਮੈਂ ਜ਼ਰਾ ਸ਼ਹਿਰ ਤੋਂ ਦੋ ਤਿੰਨ ਘੰਟੇ ਦੀ ਦੂਰੀ 'ਤੇ ਬਾਹਰ ਕੰਮ ਲਈ ਜਾਣਾ ਸੀ ਜ਼ਰੂਰੀ ਅਤੇ ਹਾਂਜੀ ਤੁਹਾਡੀ ਜਿਹੜੀ ਕੈਬ ਹੈ ਉਹ ਆ ਤਾਂ ਟਾਈਮ ਦੇ ਨਾਲ ਹੀ ਗਈ ਸੀਗੀ ਅਤੇ ਪਰ ਇੰਨਾ ਹੈ ਕਿ ਸਟਾਰਟਿੰਗ ਦੇ ਵਿੱਚ ਹੀ ਜਦੋਂ ਮਤਲਬ ਮੇਰੇ ਘਰ ਦੇ ਬਾਹਰ ਆ ਕੇ ਕੈਬ ਖੜੀ ਹੋਈ ਤਾਂ ਪਹਿਲਾਂ ਤਾਂ ਜਲਦੀ ਸਟਾਰਟ ਨਹੀਂ ਹੋਈ ਚਲੋ ਜੇ ਸਟਾਰਟ ਹੋ ਵੀ ਗਈ ਤਾਂ ਸ਼ਹਿਰ ਤੋਂ ਜਦੋਂ ਅਸੀਂ ਬਾਹਰ ਨਿਕਲੇ ਹੀ ਹਾਂ ਹਜੇ ਬਸ ਐਂ ਹੀ ਅੱਧੇ ਕੁ ਘੰਟੇ ਦੀ ਦੂਰੀ 'ਤੇ ਜਦੋਂ ਗਏ ਤਾਂ ਉੱਥੇ ਜਾ ਕੇ ਟਾਇਰ ਪੰਕਚਰ ਹੋ ਗਿਆ ਟਾਇਰ ਪੰਚਰ ਹੋਇਆ ਤਾਂ ਫਿਰ ਜਦੋਂ ਤੁਹਾਡੇ ਜਿਹੜੇ ਡਰਾਈਵਰ ਨੇ ਉਹਨਾਂ ਨੇ ਬਿਲਕੁਲ ਵੀ ਸਹਿਯੋਗ ਦੇਣ ਦਾ ਹੀ ਮਤਲਬ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜੇ ਉਹਨਾਂ ਤੋਂ ਮਸਾਂ ਹੀ ਕਿਸੇ ਤਰੀਕੇ ਦੇ ਨਾਲ ਕਹਿ ਲੋ ਕਿ ਟਾਇਰ ਜਿਹੜਾ ਅਸੀਂ ਉਹ ਚੇਂਜ ਕੀਤਾ ਥੋੜ੍ਹਾ ਹੋਰ ਦੂਰ ਗਏ ਤਾਂ ਕਾਰ ਜਿਹੜੀ ਸੀ ਉਹ ਬਿਲਕੁਲ ਹੀ ਬੰਦ ਹੋ ਗਈ ਬਿਲਕੁਲ ਵੀ ਸਟਾਰਟ ਨਹੀਂ ਹੋਈ ਜਿੰਨਾ ਮਰਜ਼ੀ ਕੋਸ਼ਿਸ਼ ਕੀਤੀ ਪਰ ਬਿਲਕੁਲ ਵੀ ਤੁਹਾਡੇ ਜਿਹੜੇ ਡਰਾਈਵਰ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਹਾਂਜੀ ਅਸੀਂ ਦੂਜੀ ਜਿਹੜੀ ਹੈਗੀ ਹੈ ਕਾਰ ਉਹਨੂੰ ਮੰਗਵਾ ਦੇਈਏ ਜਾਂ ਕੋਈ ਮਕੈਨਿਕ ਲਾਗੇ ਬੰਨੇ ਦੇਖ ਲਈਏ ਹਾਲਾਂਕਿ ਅਸੀਂ ਮਾਰਕੀਟ ਤੋਂ ਕਾਫ਼ੀ ਦੂਰੀ 'ਤੇ ਸੀਗੇ ਪਰ ਫਿਰ ਵੀ ਤੁਹਾਡੇ ਜਿਹੜੇ ਡਰਾਈਵਰ ਹੈਗੇ ਆ ਉਹਨਾਂ ਵੱਲੋਂ ਬਿਲਕੁਲ ਵੀ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਗਿਆ ਕਿ ਹਾਂਜੀ ਸਾਡੇ ਕੋਲ ਕੋਈ ਪੈਸੇਂਜਰ ਹੈਗਾ ਹੈ ਉਹਨੇ ਅਰਜੈਂਟਲੀ ਜਾਣਾ ਹੋਵੇਗਾ ਤਾਂ ਅਸੀਂ ਥੋੜ੍ਹਾ ਬਹੁਤਾ ਹੈਲਪ ਕਰ ਦੇਈਏ ਕੁਛ ਕੋਪਰੇਸ਼ਨ ਕਰ ਦੇਈਏ ਸੋ ਇਹਦੇ ਕਰਕੇ ਜਿਹੜਾ ਮੇਰਾ ਕੰਮ ਸੀਗਾ ਮੈਂ ਜ਼ਰੂਰੀ ਆਪਣੇ ਡਾਕੂਮੈਂਟ ਜਿਹੜੇ ਸੀਗੇ ਉਹ ਸਬਮਿਟ ਕਰਵਾਉਣੇ ਸੀਗੇ ਉਹ ਤਾਂ ਲੇਟ ਹੋਏ ਹੋਏ ਨਾਲ ਸਾਰਾ ਦਿਨ ਜਿਹੜਾ ਮੈਨੂੰ ਖੱਜਲ ਖੁਆਰ ਹੋਣਾ ਪਿਆ ਉਹ ਵੱਖਰਾ ਪਹਿਲਾਂ ਵੀ ਮੈਂ ਕਈ ਵਾਰੀ ਤੁਹਾਡੀ ਏਜੰਸੀ ਤੋਂ ਜਿਹੜੀਆਂ ਕਾਰ ਦੀ ਬੁਕਿੰਗ ਸੀਗੀ ਉਹ ਕੀਤੀ ਸੀ ਪਰ ਕਿਸੇ ਵੇਲੇ ਉਹਦੀਆਂ ਕਾਰ ਦੀਆਂ ਸੀਟਾਂ ਜਿਹੜੀਆਂ ਸੀ ਉਹ ਫਟੀਆਂ ਹੁੰਦੀਆਂ ਸੀਗੀਆਂ ਕਿਸੇ ਵੇਲੇ ਕਿਸੇ ਕਾਰ ਦਾ ਹੋਰਨ ਨਹੀਂ ਸੀ ਚੱਲਦਾ ਪਰ ਮੈਨੂੰ ਸੀ ਕਿ ਚਲੋ ਹੋ ਜਾਂਦਾ ਕਿਸੇ ਵੇਲੇ ਕਿ ਐਡੀ ਵੱਡੀ ਏਜੰਸੀ ਹੈਗੀ ਹੈ ਨਹੀਂ ਕਿਸੇ ਵੇਲੇ ਛੋਟੀਆਂ ਛੋਟੀਆਂ ਚੀਜ਼ਾਂ ਵੱਲ ਧਿਆਨ ਜਾਂਦਾ ਪਰ ਕੱਲ੍ਹ ਮੇਰਾ ਇੰਨਾ ਜ਼ਰੂਰੀ ਕੰਮ ਸੀਗਾ ਕਿ ਇੱਕ ਤਾਂ ਮਤਲਬ ਮੇਰਾ ਉੱਥੇ ਟਾਈਮ 'ਤੇ ਪਹੁੰਚਣਾ ਜ਼ਰੂਰੀ ਸੀ ਟਾਈਮ 'ਤੇ ਪਹੁੰਚਣ ਦੀ ਬਜਾਏ ਮਤਲਬ ਇੰਨਾ ਵਾ ਕਿ ਮੈਨੂੰ ਤੁਹਾਡੇ ਡਰਾਈਵਰ ਨੇ ਉੱਥੇ ਟਾਈਮ 'ਤੇ ਪਹੁੰਚਾਉਣਾ ਤਾਂ ਕੀ ਸੀਗਾ ਸਗੋਂ ਜੇ ਮੈਂ ਉਹਨਾਂ ਨੂੰ ਥੋੜ੍ਹਾ ਕਹਿੰਦੀ ਕਿ ਹਾਂਜੀ ਤੁਸੀਂ ਮਕੈਨਿਕ ਨੂੰ ਲੱਭੋ ਜਾਂ ਮੈਨੂੰ ਕੋਈ ਦੂਜੀ ਕਾਰ ਅਰੇਂਜ ਕਰ ਦਿਓ ਤਾਂ ਉਹ ਸਗੋਂ ਮੇਰੇ ਨਾਲ ਬੋਲਦੇ ਵੀ ਇੰਨਾ ਔਖਾ ਹੋ ਕੇ ਕਿ ਮੈਂ ਤੁਹਾਨੂੰ ਕੀ ਦੱਸਾਂ ਸੋ ਮੇਰੀ ਇਹ ਹੀ ਤੁਹਾਨੂੰ ਰਿਕੁਐਸਟ ਹੈਗੀ ਹੈ ਕਿ ਤੁਸੀਂ ਪਲੀਜ਼ ਆਪਣੀ ਜਿਹੜੀ ਸਰਵਿਸ ਹੈ ਉਹਨੂੰ ਥੋੜ੍ਹਾ ਇੰਪਰੂਵ ਕਰੋ ਤਾਂ ਕਿ ਤੁਹਾਡੇ ਜਿਹੜੇ ਕਸਟਮਰ ਹੈਗੇ ਆ ਉਹਨਾਂ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ